ਪੰਜਾਬ ਵਿੱਚ ਕਾਰੋਵਾਰ ਵਿਕਾਸ ਲਈ ਬਾਹਰਲੇ ਲੋਕਾਂ ਨੂੰ ਆ ਕੇ ਪੰਜਾਬ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਵਿੱਚ ਕਾਰੋਬਾਰ ਅਤੇ ਵਿਕਾਸ ਦੀ ਯੋਜਨਾ ਦਾ ਪ੍ਰਬੰਧ ਹੋ ਸਕਦਾ ਹੈ